ਬਿਲਕੁਲ ਕਈ ਵਾਰ ਹਸਪਤਾਲਾਂ ਦੇ ਵਿੱਚ ਜਾਂਦੇ ਹਾਂ ਅਤੇ ਸਾਨੂੰ ਉੱਥੋਂ ਦੇ ਜਿਹੜੇ ਡਾਕਟਰ ਨੇ ਜਿਨ੍ਹਾਂ 'ਤੇ ਅਸੀਂ ਨਿਰਭਰ ਹੋ ਕੇ ਆਪਣਾ ਮਰੀਜ਼ ਲੈ ਕੇ ਜਾਂਦੇ ਹਾਂ ਕਈ ਵਾਰ ਉਹਨਾਂ ਦੇ ਵਿਵਹਾਰ ਦੇ ਵਿੱਚ ਅਣਗਹਿਲੀ ਜਿਹੀ ਲਾਪਰਵਾਹੀ ਢੀਠਪਣ ਜਿਹਾ ਦੇਖਣ ਨੂੰ ਮਿਲਦਾ ਜਿਹੜਾ ਚੰਗਾ ਨਹੀਂ ਲੱਗਦਾ ਕਿਉਂਕਿ ਜਦੋਂ ਅਸੀਂ ਕਿਸੇ ਮਰੀਜ਼ ਨੂੰ ਲੈ ਕੇ ਜਾਂਦੇ ਹਾਂ ਉਹਨਾਂ ਲਈ ਤਾਂ ਉਹ ਰੋਜ਼ ਦੇ ਜਿਵੇਂ ਹਰ ਰੋਜ਼ ਮਰੀਜ਼ ਆਉਂਦੇ ਨੇ ਉਹਨਾਂ ਲਈ ਤਾਂ ਇੱਕੋ ਕਸਟਮਰ ਮਰੀਜ਼ ਹੀ ਆ ਪਰ ਜਿਨ੍ਹਾਂ ਦੇ ਪਰਿਵਾਰ ਦਾ ਇੱਕ ਹਿੱਸਾ ਹੁੰਦਾ ਉਹ ਉਨ੍ਹਾਂ ਪ੍ਰਤੀ ਉਨ੍ਹਾਂ ਦੇ ਹਿਰਦੇ ਅੰਦਰ ਆਪਣੇ ਉਸ ਜੀਵ ਪ੍ਰਤੀ ਕਿੰਨਾ ਪਿਆਰ ਹੁੰਦਾ ਸਨੇਹ ਹੁੰਦਾ ਪਰ ਉਹ ਡਾਕਟਰ ਆ ਜਿਨ੍ਹਾਂ ਦਾ ਰੋਜ਼ਾਨਾ ਦਾ ਇੱਕ ਕਿੱਤਾ ਬਣ ਜਾਂਦਾ ਅਤੇ ਉਹਨਾਂ ਦੀ ਲਾਪਰਵਾਹੀ ਦੇਖ ਕੇ ਕਈ ਵਾਰ ਮਨ ਨੂੰ ਬਹੁਤ ਦੁੱਖ ਵੀ ਹੁੰਦਾ ਕਿ ਉਹ ਕਿਸ ਤਰੀਕੇ ਦੇ ਨਾਲ ਡੀਲਿੰਗ ਕਰਦੇ ਨੇ ਕਿਸ ਤਰੀਕੇ ਦੇ ਨਾਲ ਉਹ ਬਿਹੇਵ ਕਰਦੇ ਨੇ ਬਿਹੇਵ ਉਹਨਾਂ ਦਾ ਵਿਵਹਾਰ ਜਿਹੜਾ ਉਹ ਚੰਗਾ ਨਹੀਂ ਲੱਗਦਾ ਸੋ ਸਾਧਨਾਂ ਦੀ ਉਪਲਬਧਤਾ ਵੀ ਮਾਇਨੇ ਨਹੀਂ ਰੱਖਦੀ ਜੇ ਅੱਗੇ ਡਾਕਟਰ ਦਾ ਵਿਵਹਾਰ ਚੰਗਾ ਨਹੀਂ ਆ ਜੇ ਵਿਵਹਾਰ ਚੰਗਾ ਹੋਵੇ ਅਤੇ ਸੋਹਣੇ ਢੰਗ ਦੇ ਨਾਲ ਡੀਲਿੰਗ ਕਰੇ ਤਾਂ ਇਹ ਚੀਜ਼ਾਂ ਮਾਇਨੇ ਨਹੀਂ ਰੱਖਦੀਆਂ ਬਾਕੀ ਸਾਰੇ ਡਾਕਟਰ ਨਹੀਂ ਇਵੇਂ ਦੇ ਕੁਝ ਕੁ ਅਨੁਭਵ ਸੀਗਾ ਮੇਰਾ ਜਿਹੜਾ ਮੈਨੂੰ ਵੇਖਣ ਦੇ ਵਿੱਚ ਮਿਲਿਆ ਬਾਕੀ ਠੀਕ ਆ ਜਿਹੜੇ ਵੀ ਹਸਪਤਾਲ ਨੇ ਸੋਹਣੇ ਢੰਗ ਦੇ ਨਾਲ ਕਾਰਜ ਕਰਦੇ ਨੇ ਮਹਿੰਗਾਈ ਇਹ ਤਾਂ ਕਹਿਣਾ ਪਵੇਗਾ ਇਹ ਵੀ ਇੱਕ ਕਹਿ ਲਉ ਕਿ ਕਮਾਈ ਦੇ ਸਾਧਨ ਲੋਕਾਂ ਨੇ ਬਣਾ ਲਏ ਨੇ ਜਿਸ ਕਰਕੇ ਮਹਿੰਗਾਈ ਹੋਣੀ ਵਾਜਬ ਆ ਅਤੇ ਹੋ ਵੀ ਰਹੀ ਆ ਆਮ ਬੰਦੇ ਦੇ ਵੱਸ ਦੇ ਵਿੱਚ ਚੰਗਾ ਇਲਾਜ ਕਰਵਾਉਣਾ ਵੀ ਨਹੀਂ ਜੋ ਸਹੀ ਤਰੀਕੇ ਦੇ ਨਾਲ ਆਪਣਾ ਇਲਾਜ ਕਰਵਾ ਸਕੇ